ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਖੇਤੀ ਆ ਪੂਰੀ ਤਰ੍ਹਾਂ ਮੌਸਮ 'ਤੇ ਨਿਰਭਰ ਕਰਦੀ ਆ ਜਿਹੜੇ ਕਿਸਾਨ ਆ ਉਹ ਮਤਲਬ ਕਿ ਕਣਕ ਦੀ ਵੀ ਬਿਜਾਈ ਕਰਦੇ ਆ ਅਤੇ ਝੋਨੇ ਦੀ ਵੀ ਬਿਜਾਈ ਕਰਦੇ ਆ ਅਤੇ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਵਾ ਕਿ ਜਿਹੜਾ ਝੋਨਾ ਵਾ ਉਹ ਓਦੇ ਉਹਦੀ ਬਿਜਾਈ ਕਰਨ ਸਮੇਂ ਆ ਸਾਨੂੰ ਮੀਹ ਦੀ ਜ਼ਰੂਰਤ ਹੁੰਦੀ ਆ ਆਪਾਂ ਨੂੰ ਜਦੋਂ ਕੱਦੂ ਕਰਨਾ ਪੈਂਦਾ ਵਾ ਤਾਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਕਿਸੇ ਵੇਲੇ ਕੀ ਆ ਭਾਵੇਂ ਟਿਊਬਵੈਲ ਹੁੰਦੇ ਆ ਪਰ ਕਿਸੇ ਵੇਲੇ ਬਿਜਲੀ ਬੁਜਲੀ ਦੇ ਕੱਟ ਲੱਗ ਜਾਂਦੇ ਆ ਅਤੇ ਉਹਦੇ ਨਾਲ ਕੀ ਹੁੰਦਾ ਵਾ ਕਿ ਆਪਾਂ ਪਾਣੀ ਨਹੀਂ ਦੇ ਸਕਦੇ ਅਤੇ ਆਪਾਂ ਨੂੰ ਇਹ ਜਿਹੜਾ ਜਦੋਂ ਝੋਨਾ ਲਗਾਉਣਾ ਹੁੰਦਾ ਸਰਕਾਰ ਵੱਲੋਂ ਹੀ ਸਮਾਂ ਨਿਯਤ ਕੀਤਾ ਜਾਂਦਾ ਨਿਸ਼ਚਿਤ ਕੀਤਾ ਜਾਂਦਾ ਵਾ ਇਹਦੇ ਕਰਕੇ ਸਾਨੂੰ ਜਿਹੜੀ ਆ ਮਤਲਬ ਕਿ ਬਰਸਾਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਜੇਕਰ ਮੀਂਹ ਪੈ ਜਾਂਦਾ ਵਾ ਤਾਂ ਫਿਰ ਤਾਂ ਕੱਦੂ ਕਰਨਾ ਸੌਖਾ ਹੋ ਜਾਂਦਾ ਵਾ ਅਤੇ ਝੋਨਾ ਵਧੀਆ ਲੱਗਦਾ ਜੇਕਰ ਮੀਂਹ ਨਹੀਂ ਪੈਂਦਾ ਤਾਂ ਫਿਰ ਕੀ ਆ ਕਿ ਆਪਾਂ ਨੂੰ ਜਦੋਂ ਝੋਨਾ ਲੱਗਾ ਹੁੰਦਾ ਵਾ ਪਾਣੀ ਦੀ ਘਾਟ ਦੇ ਕਾਰਨ ਜੇਕਰ ਝੋਨੇ ਦੀ ਬਿਜਾਈ ਨਹੀਂ ਹੋਈ ਹੁੰਦੀ ਤਾਂ ਫਿਰ ਇਹਦੇ ਜਿਹੜੇ ਪੱਤੇ ਆ ਜਿਹੜੀ ਜੜ੍ਹ ਵਾ ਉਹ ਪੀਲਾ ਪਨ ਆ ਜਾਂਦਾ ਵਾ ਅਤੇ ਇਹਦਾ ਜਿਹੜਾ ਵਾ ਕਿ ਡਿੱਗ ਜਾਂਦਾ ਵਾ ਫਿਰ ਝੋਨਾ ਖਰਾਬ ਹੋ ਜਾਂਦਾ ਵਾ ਅਤੇ ਜੇਕਰ ਆਪਾਂ ਕਣਕ ਦੀ ਗੱਲ ਕਰਦੇ ਹਾਂ ਤਾਂ ਕਣਕ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਹ ਜਿਹੜੀ ਆ ਠੰ ਠੰਡ ਵਿੱਚ ਇਹਨੂੰ ਨਮੀਂ ਦੀ ਜ਼ਰੂਰਤ ਹੁੰਦੀ ਆ ਅਤੇ ਇਹ ਠੀਕ ਰਹਿੰਦੀ ਆ ਪਰ ਜੇਕਰ ਜਦੋਂ ਕਣਕ ਦੀ ਕਟਾਈ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾ ਨ ਮੀਂਹ ਹਨੇਰੀ ਆ ਜਾਵੇ ਅਤੇ ਇਹ ਡਿੱਗ ਪੈਂਦੀ ਆ ਇਹਦੇ ਨਾਲ ਕੀ ਹੁੰਦਾ ਵਾ ਕਿ ਇਹ ਕਾਲੀ ਕਾਲੀ ਪੈ ਜਾਂਦੀ ਹੈ ਕਣਕ ਅਤੇ ਇਹਦਾ ਜਿਹੜਾ ਵਾ ਝਾੜ ਬਿਲਕੁਲ ਹੀ ਖਰਾਬ ਹੋ ਜਾਂਦਾ ਵਾ